ਅੱਜ ਕੱਲ੍ਹ ਬੱਚੇ ਜਿਹੜੀਆਂ ਨਵੀਆਂ ਖੇਡਾਂ ਖੇਡਦੇ ਹਨ ਉਹ ਔਨਲਾਈਨ ਪਬਜੀ ਜੀ ਟੀ ਏ ਫਰੀ ਫਾਇਰ ਵਗੈਰਾ ਮੋਬਾਇਲਾਂ 'ਤੇ ਗੇਮਾਂ ਖੇਡਦੇ ਨੇ ਪਰ ਪਹਿਲਾਂ ਜੋ ਗੇਮਾਂ ਸਨ ਗੇਮਾਂ ਸਨ ਉਹ ਆਪਣਾ ਕਬੱਡੀ ਵਗੈਰਾ ਕਬੱਡੀ ਹੋ ਗਿਆ ਫੁੱਟਬਾਲ ਹੋ ਗਿਆ ਕ੍ਰਿਕਟ ਹੋ ਗਿਆ ਗ ਗਰਾਊਂਡ ਲੈਵਲ 'ਤੇ ਖੇਡੀਆਂ ਜਾਂਦੀਆਂ ਪਰ ਹੁਣ ਅੱਜ ਕੱਲ੍ਹ ਨਵੇਂ ਬੱਚੇ ਆ ਜੋ ਮੋਬਾਈਲਾਂ 'ਤੇ ਹੀ ਜੋ ਦ ਦਿਮਾਗੀ ਤੌਰ 'ਤੇ ਖੇਡੀਆਂ ਜਾਂਦੀਆਂ ਹਨ ਉਹੀ ਖੇਡਦੇ ਹਨ ਇਹਨਾਂ ਵਿੱਚ ਇੱਕ ਫਰੀ ਫਾਇਰ ਹੈ ਜਿਵੇਂ ਉਸ ਵਿੱਚ ਟਾਸਕ ਦਿੱਤਾ ਜਾਂਦਾ ਏ ਉਹ ਟਾਸਕ ਕੰਪਲੀਟ ਕਰਨਾ ਹੁੰਦਾ ਇਹੀ ਗੇਮਾਂ ਨੇ ਜੀ ਔਨਲਾਈਨ ਅੱਜ ਕੱਲ੍ਹ ਬੱਚਿਆਂ ਦੀਆਂ